ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਮੇਰਾ ਨਾਮ ਸਿਮਰਨਜੀਤ ਕੌਰ ਹੈ ਅਤੇ ਮੇਰੇ ਮੈਂ ਆਪਣੇ ਇੱਥੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁਰਖਪੁਰ ਤੋਂ ਬੋਲ ਰਹੀ ਹਾਂ ਮੇਰੀ ਇਕ ਫਰੈਂਡ ਨੇ ਤੁਹਾਡੇ ਬਾਰੇ ਦੱਸਿਆ ਸੀਗਾ ਕਿ ਤੁਸੀਂ ਯੋਗਾ ਟੀਚਰ ਹੋ ਅਤੇ ਮੈਂ ਵੀ ਯੋਗਾ ਬਾਰੇ ਕੁਝ ਟਿਪਸ ਲੈਣਾ ਚਾਹੁੰਦੀ ਸੀ ਤੁਹਾਡੇ ਕੋਲੋਂ ਹਾਂਜੀ ਹਾਂਜੀ ਹਾਂਜੀ ਮੈਡਮ ਸ਼ਾਮ ਦਾ ਟਾਈਮ ਠੀਕ ਹੈ ਹਾਂਜੀ ਮੈਮ ਮੈਡਮ ਮੈਂ ਵੀ ਸਕੂਲ ਟੀਚ ਕਰਦੀ ਹਾਂ ਮੈਮ ਤੁਸੀਂ ਚਾਰ ਤੋਂ ਛੇ ਦਾ ਬੈਚ ਕਰ ਦਓਗੇ ਮੇਰਾ ਹਾਂਜੀ ਹਾਂਜੀ ਮੈਮ ਪਹਿਲਾਂ ਤਾਂ ਮੈਂ ਇਕੱਲੀ ਕਰਕੇ ਦੇਖਾਂਗੀ ਜੇਕਰ ਮੈਨੂੰ ਲੱਗੇਗਾ ਕਿ ਹਾਂ ਵਧੀਆ ਚੱਲ ਰਿਹਾ ਆ ਫਿਰ ਮੈਂ ਅਗਾਂਹ ਹੋਰ ਵੀ ਕਿਸੇ ਨੂੰ ਦੱਸਾਂਗੀ ਹਾਂਜੀ ਜੀ ਵੰਨ ਆਰ ਹਾਂਜੀ ਹਾਂ ਹਾਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ

ਠੀਕ ਹੈ ਮੈਮ ਨਹੀਂ ਬਸ ਮੈਂ ਇਹ ਹੀ ਮੈਮ ਕਨਫਰਮ ਨਹੀਂ ਕਰਨਾ ਚਾਹੁੰਦੀ ਸੀਗੀ ਕਿ ਟਾਈਮਿੰਗ ਜਿਹੜੀ ਸ਼ਾਮ ਦੀ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ ਜੇਕਰ ਮਿਲ ਸਕਦੀ ਹੈ ਤਾਂ ਟਾਈਮ ਵੀ ਵਨ ਆਰ ਦਾ ਹੀ ਚਾਹੀਦਾ ਸੀਗਾ ਜੀ ਉਨ੍ਹੇ ਦੇ ਵਿੱਚ ਵੀ ਅਸੀਂ ਜਿਹੜਾ ਮਤਲਬ ਕਿ ਹੋ ਸਕੇ ਹਾਂਜੀ ਹਾਂਜੀ ਪਰ ਮੈਡਮ ਇਹ ਫੀਸ ਕੋਈ ਐਡਵਾਂਸ ਦੇਣ ਦੀ ਜ਼ਰੂਰਤ ਤਾਂ ਨਹੀਂ ਚਲੋ ਠੀਕ ਹੈ ਮੈਮ

ਠੀਕ ਹੈ ਮੈਂ ਕੱਲ੍ਹ ਤੋਂ ਜੁਆਇਨ ਕਰ ਰਹੀ ਹਾਂ ਮੈਂ ਓਕੇ ਮੈਮ ਥੈਂਕ ਯੂ